ਜੇਕਰ ਅਸੀਂ ਤਕਨਾਲੋਜੀ ਦੀ ਵੱਖ ਵੱਖ ਖੇਤਰਾਂ ਵਿੱਚ ਮਹੱਤਤਾ ਦੀ ਗੱਲ ਕਰੀਏ ਤਾਂ ਅੱਜ ਕੱਲ੍ਹ ਤਕਨਾਲੋਜੀ ਨੇ ਬਿਰਧ ਅਵਸਥਾ ਵਿੱਚ ਜੋ ਜੋ ਆਦਮੀ ਜਾਂ ਔਰਤਾਂ ਹਨ ਜਾਂ ਫਿਰ ਜੋ ਦ੍ਰਿਸ਼ਟੀਹੀਣ ਆਦਮੀ ਜਾਂ ਔਰਤਾਂ ਹਨ ਉਨ੍ਹਾਂ ਦੀ ਰੋਜ਼ਾਨਾ ਜੀਵਨ ਵਿੱਚ ਵੱਖ ਵੱਖ ਗਤੀਵਿਧੀਆਂ ਵਿੱਚ ਬਹੁਤ ਹੀ ਮ ਮਦਦ ਕੀਤੀ ਹੈ ਇਸ ਸੰਬੰਧੀ ਮੁੱਖ ਤੌਰ 'ਤੇ ਅਗਰ ਵਰ ਬਿਰਧਾਂ ਦੀ ਗੱਲ ਕੀਤੀ ਜਾਵੇ ਤਾਂ ਬਿਰਧਾਂ ਦੇ ਲਈ ਅਸੀਂ ਇੱਕ ਰਿਮੋਟ ਹੈਲਥਕੇਅਰ ਜਿਸ ਨੂੰ ਕਿ ਅਸੀਂ ਸਵਸਥ ਨਾਲ ਸੰਬੰਧਿਤ ਇੱਕ ਟੈਕਨੋਲਜੀ ਦੇ ਵਿੱਚ ਕ੍ਰਾਂਤੀ ਦੀ ਗੱਲ ਕਰਦੇ ਹਾਂ ਉਹ ਉਸ ਨੇ ਬੜਾ ਵੱਡਾ ਯੋਗਦਾਨ ਪਾਇਆ ਅਤੇ ਰਿਮੋਟ ਹੈਲਥਕੇਅਰ ਦੀ ਗੱਲ ਕਰੀਏ ਕਿ ਕਿਸੇ ਦੂਰ ਦੁਰਾਡੇ ਖੇਤਰ ਦੇ ਵਿੱਚ ਕੋਈ ਬਜ਼ੁਰਗ ਔਰਤ ਜਾਂ ਆਦਮੀ ਹਨ ਤਾਂ ਉਹਨਾਂ ਦੀ ਸਿਹਤ ਦੀ ਜਾਂਚ ਵੱਖ ਵੱਖ ਤਰੀਕਿਆਂ ਨਾਲ ਉਹ ਵਿਅਕਤੀ ਵੀ ਕਰ ਸਕਦਾ ਹੈ ਜੋ ਵਿਅਕਤੀ ਤਕਨੀਕੀ ਤੌਰ 'ਤੇ ਐਨਾ ਜ਼ਿਆਦਾ ਸ ਸਕਿੱਲਡ ਨਹੀਂ ਹੈ ਅਤੇ ਉਹ ਇਹਨਾਂ ਵੱਖ ਵੱਖ ਸਰੀਰ ਨਾਲ ਸੰਬੰਧਿਤ ਵੱਖ ਵੱਖ ਮਾਪਦੰਡਾਂ ਨੂੰ ਅੱਗੇ ਡਾਕਟਰ ਨੂੰ ਭੇਜ ਸਕਦਾ ਹੈ ਸੋ ਟੈਲੀਕਮਿਊਨੀਕੇਸ਼ਨ ਦੇ ਜ਼ਰੀਏ ਅਤੇ ਉਹ ਟੈਲੀਮੈਂਟਰੀ ਦੇ ਜ਼ਰੀਏ ਉਹਨਾਂ ਵੱਖ ਵੱਖ ਮਾਪਦੰਡਾਂ ਜਾਂ ਵੱਖ ਵੱਖ ਪੈਰਾਮੀਟਰਾਂ ਦੇ ਆਧਾਰ 'ਤੇ ਬਿਮਾਰੀ ਦਾ ਪਤਾ ਲਗਾ ਸਕਦਾ ਹੈ ਦ੍ਰਿਸ਼ਟੀਹੀਣਾਂ ਦੀ ਗੱਲ ਕਰੀਏ ਤਾਂ ਦ੍ਰਿਸ਼ਟੀਹੀਣਾਂ ਨੂੰ ਪੜ੍ਹਨ ਦੇ ਵਿੱਚ ਬਹੁਤ ਹੀ ਮੁਸ਼ਕਲ ਪੇਸ਼ ਆਉਂਦੀ ਹੈ ਇਸ ਸੰਬੰਧ ਵਿੱਚ ਤਕਨਾਲੋਜੀ ਨੇ ਬਹੁਤ ਹੀ ਵੱਡਾ ਯੋਗਦਾਨ ਪੈਦਾ ਅ ਕੀਤਾ ਹੈ ਜਿਸ ਤਰ੍ਹਾਂ ਕਿ ਗੂਗਲ ਟਰਾਂਸਲੇਟਰ ਜਾਂ ਗੂਗਲਾਂ ਦੀਆਂ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਐਪਸ ਹਨ ਜੋ ਕਿ ਤੁਹਾਡੀ ਤੁਹਾਡੇ ਬੋਲ ਨੂੰ ਲਿਖਤੀ ਰੂਪ ਵਿੱਚ ਕ ਵ ਕਨਵਰਟ ਕਰ ਦਿੰਦੀਆਂ ਹਨ ਅਤੇ ਇਸ ਤੋਂ ਇਲਾਵਾ ਜੇਕਰ ਤੁਸੀਂ ਕੋਈ ਕੈਮਰੇ ਦੀ ਮਦਦ ਦੇ ਨਾਲ ਕੋਈ ਲਿਖਤ ਹੈ ਉਸ ਲਿਖਤ ਨੂੰ ਬੋਲ ਦੇ ਰੂਪ ਵਿੱਚ ਵੀ ਕਨਵਰਟ ਕਰ ਫੋਟੋ ਫੋਟੋ ਖਿੱਚ ਕੇ ਬੋਲ ਦੇ ਰੂਪ ਵਿੱਚ ਵੀ ਉਸ ਨੂੰ ਤਬਦੀਲ ਕਰ ਦਿੰਦੀਆਂ ਹਨ ਸੋ ਇਹੀ ਮੁੱਖ ਤੌਰ 'ਤੇ ਤਕਨਾਲੋਜੀ ਦੀਆਂ ਤਕਨਾਲੋਜੀ ਦੀਆਂ ਦੇਣਾਂ ਹਨ ਜੋ ਕਿ ਬਿਰਧਾਂ ਅਤੇ ਦ੍ਰਿਸ਼ਟੀਹੀਣ ਵ ਵਿਅਕਤੀਆਂ ਦੀਆਂ ਦੀ ਮਦਦ ਕਰਦੀਆਂ ਹਨ ਧੰਨਵਾਦ ਜੀ